ਸਤਿ ਸ਼੍ਰੀ ਅਕਾਲ ਜੀ ਅਮਨ ਟੈਕਸੀ ਸਟੈਂਡ ਤੋਂ ਬੋਲਦੇ ਆ ਜੀ ਅਸੀਂ ਤੁਹਾਡੀ ਟੈਕਸੀ ਦੀ ਬੁਕਿੰਗ ਕੀਤੀ ਹੋਈ ਤੀ ਹਫਤਾ ਪਹਿਲਾਂ ਪਰ ਤੁਸੀਂ ਹਜੇ ਪਹੁੰਚੇ ਨਹੀਂ ਅਸੀਂ ਖਰੜ ਤੋਂ ਅੰਮ੍ਰਿਤਸਰ ਜਾਣਾ ਸੀ ਸਾਢੇ ਛੇ ਹੋ ਗਏ ਅਸੀਂ ਉੱਥੇ ਡੋਕਟਰ ਤੋਂ ਦੱਸ ਵਜੇ ਦਾ ਟਾਇਮ ਲਿਆ ਹੋਇਆ ਹੈ ਹੁਣ ਤੁਸੀਂ ਅਜੇ ਕਿੱਥੇ ਹਨ ਸਾਢੇ ਛੇ ਵਜੇ ਸਾਡੇ ਕੋਲ ਪਹੁੰਚ ਜੋ ਅਸ ਅ ਜਾਣ ਵਿੱਚ ਟ੍ਰੈਫਿਕ ਜਾਮ ਵੀ ਹੋ ਸਕਦਾ ਏ ਅਤੇ ਹੋਰ ਵੀ ਕੋਈ ਪਰੋਬਲਮਾਂ ਆ ਸਕਦੀਆਂ ਏ ਅਸੀਂ ਡਾਕਟਰ ਨੂੰ ਟਾਈਮ 'ਤੇ ਮਿਲਣਾ ਹੈ ਪਰ ਛੇਤੀ ਆਪਣੀ ਗੱਡੀ ਭੇਜਣ ਦੀ ਕੋਸ਼ਿਸ਼ ਕਰੋ